ਪੰਜਾਬ ਇੱਕ ਅਜਿਹਾ ਮੁਲਕ ਹੈ ਜਿੱਥੇ ਬਹੁਤ ਜ਼ਿਆਦਾ ਹਮਲਾਵਰਾਂ ਨੇ ਹਮਲਾ ਕੀਤਾ ਅਤੇ ਪੰਜਾਬੀ ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਨੂੰ ਬਹੁਤ ਪ੍ਰਭਾਵਿਤ ਕੀਤਾ ਉਹਨਾਂ ਦੇ ਕੁਝ ਅੰਸ਼ ਆ ਜਿਹੜੇ ਉਹ ਪੰਜਾਬੀ ਸੱਭਿਆਚਾਰ ਦੇ ਵਿੱਚ ਸਮੋਏ ਹੋਏ ਹਨ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੇ ਦੌਰਾਨ ਇੱਥੋਂ ਦੀ ਜਿਹੜੀ ਰਾਜ ਭਾਸ਼ਾ ਉਹ ਫਾਰਸੀ ਸੀ ਜਦੋਂ ਕਿ ਆਮ ਲੋਕ ਜਿਹੜੇ ਬੋਲਚਾਲ ਦੀ ਭਾਸ਼ਾ ਉਹ ਪੰਜਾਬੀ ਵਿੱਚ ਸੀ ਅੰਗਰੇਜ਼ੀ ਕਾਲ ਦੇ ਦੌਰਾਨ ਵੀ ਜਿਹੜੀ ਉਰਦੂ ਭਾਸ਼ਾ ਸਾਡੀ ਰਾਜ ਭਾਸ਼ਾ ਸੀ ਅਤੇ ਪੰਜਾਬੀ ਭਾਸ਼ਾ ਆਮ ਬੋਲ ਚਾਲ 'ਚ ਬੋਲੀ ਜਾਂਦੀ ਸੀ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ 'ਤੇ ਸਭ ਤੋਂ ਵੱਡਾ ਪ੍ਰਭਾਵ ਆ ਭਾਰਤ ਪਾਕਿਸਤਾਨੀ ਵੰਡ ਦੇ ਨਾਲ ਪਿਆ ਸੀ ਉਸ ਦੇ ਵਿੱਚ ਅਜਿਹਾ ਹੋਇਆ ਕਿ ਪੰਜਾਬ ਦੀ ਵੰਡ ਹੋ ਗਈ ਜਿਸ ਦੇ ਕਾਰਨ ਅੱਧਾ ਪੰਜਾਬ ਆ ਪਾਕਿਸਤਾਨ ਦੇ ਵਿੱਚ ਚਲਾ ਗਿਆ ਅਤੇ ਅੱਧਾ ਪੰਜਾਬ ਭਾਰਤ ਦੇ ਵਿੱਚ ਰਹਿ ਗਿਆ ਸੀ ਪਾਕਿਸਤਾਨੀ ਪੰਜਾਬ ਦੇ ਵਿੱਚ ਜਿਹੜੀ ਪੰਜਾਬੀ ਦੀ ਸਥਿਤੀ ਜ਼ਿਆਦਾ ਵਧੀਆ ਨਹੀਂ ਹੈਗੀ ਅਤੇ ਉੱਥੇ ਜ਼ਿਆਦਾਤਰ ਜਿਹੜੀ ਪੰਜਾਬੀ ਆ ਉਰਦੂ ਅਤੇ ਫਾਰਸੀ ਦਾ ਬਹੁਤ ਜ਼ਿਆਦਾ ਉਹ 'ਤੇ ਪ੍ਰਭਾਵ ਦੇਖਿਆ ਜਾ ਸਕਦਾ ਹੈ ਭਾਰਤੀ ਪੰਜਾਬ ਦੇ ਵਿੱਚ ਭਾਵੇਂ ਕਿ ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਪ੍ਰਾਪਤ ਹੈ ਸਥਿਤੀ ਕੁਝ ਚੰਗੀ ਹੈ ਪਰੰਤੂ ਅੱਜ ਦੇ ਸਮੇਂ ਦੇ ਵਿੱਚ ਹਿੰਦੀ ਭਾਸ਼ਾ ਦਾ ਅੰਗਰੇਜ਼ੀ ਭਾਸ਼ਾ ਦਾ ਪ੍ਰਭਾਵ ਆ ਜਿਹੜਾ ਉਹ ਪੰਜਾਬੀ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਸੱਭਿਆਚਾਰ ਦੇ ਪੱਖ ਤੋਂ ਦੇਖਿਆ ਜਾਵੇ ਤਾਂ ਪੰਜਾਬੀ ਸੱਭਿਆਚਾਰ ਦੇ ਵਿੱਚ ਜਿਹੜਾ ਪੱਛਮੀ ਸੱਭਿਆਚਾਰ ਦੀ ਝਲਕ ਆ ਉਹ ਦੇਖੀ ਜਾ ਸਕਦੀ ਹੈ ਅਤੇ ਜਿਹੜਾ ਸੱਭਿਆਚਾਰ ਆ ਉਹ ਪੱਛਮ ਦੇ ਸੱਭਿਆਚਾਰ ਤੋਂ ਜ਼ਿਆਦਾ ਪ੍ਰਭਾਵਿਤ ਹੋ ਰਿਹਾ ਸਮੁੱਚੇ ਰੂਪ ਦੇ ਵਿੱਚ ਜਿਹੜੀ ਪੰਜਾਬੀ ਹੈ ਇਹ ਸਮੇਂ ਸਮੇਂ 'ਤੇ ਵੱਖ ਵੱਖ ਵੱਖ ਵੱਖ ਹਮਲਾਵਰਾਂ ਦੁਆਰਾ ਕੀਤੇ ਹਮਲਿਆਂ ਉਹਨਾਂ ਦੇ ਸੱਭਿਆਚਾਰ ਤੋਂ ਅਤੇ ਵੱਖ ਵੱਖ ਸਾਡੀਆਂ ਹੋਰਨਾਂ ਭਾਸ਼ਾਵਾਂ ਤੋਂ ਬਹੁਤ ਪ੍ਰਭਾਵਿਤ ਹੋਈ ਹੈ